ਸਾਡੇ ਘਰ ਵਿੱਚ ਜਦੋਂ ਮਹਿਮਾਨ ਆਉਂਦੇ ਹਨ ਤਦ ਅਸੀਂ ਉਹਨਾਂ ਨੂੰ ਬਹੁਤ ਪਿਆਰ ਅਤੇ ਖੁਸ਼ੀ ਨਾਲ ਮਿਲਦੇ ਹਾਂ ਅਤੇ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਬਣਾਉਂਦੇ ਆ ਜਿਵੇਂ ਕਿ ਪਕੌੜੇ ਸਮੋਸੇ ਜੂਸ ਚਾਹ ਬਿਸਕਿਟ ਆਦਿ ਬਣਾਉਂਦੇ ਆ ਅਤੇ ਉਹ ਬਹੁਤ ਚਾਅ ਨਾਲ ਖਾਂਦੇ ਆ ਅਤੇ ਪਕਵਾਨਾਂ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਬਾਅਦ ਵਿੱਚ ਇਕੱਠੇ ਬੈਠ ਕੇ ਸਭ ਗੱਲਾਂ ਬਾਤਾਂ ਕਰਦੇ ਹਾਂ ਪੁਰਾਣੀਆਂ ਗੱਲਾਂ ਯਾਦ ਕਰਦੇ ਹਨ ਇੱਕ ਦੂਜੇ ਦੇ ਕਿੱਸੇ ਸੁਣਦੇ ਹਾਂ ਅਤੇ ਬਾਹਰ ਘੁੰਮ ਕੇ ਆਉਂਦੇ ਹਾਂ ਜਾਣ ਲੱਗੇ ਪਿਆਰ ਦੇ ਵਜੋਂ ਪੈਸਿਆਂ ਦਾ ਸ਼ਗਨ ਜਾਂ ਇੱਕ ਦੂਜੇ ਨੂੰ ਕੱਪੜੇ ਬਣਾ ਕੇ ਦਿੱਤੇ ਜਾਂਦੇ ਹਨ ਅਤੇ ਉਹ ਬਹੁਤ ਪਿਆਰ ਨਾਲ ਲੈਂਦੇ ਹਨ